ਅੱਜ ਦੇ ਸਮੇਂ ਵਿੱਚ ਸਕੂਲ ਤੋਂ ਬਾਅਦ ਬੱਚਿਆਂ ਨੂੰ ਟਿਊਸ਼ਨ ਲਗਾਉਣਾ ਪੈਂਦਾ ਹੈ ਕਿਉਂਕਿ ਜਿਹੜੇ ਮਾਂ ਪਿਓ ਹੁੰਦੇ ਆ ਉਹ ਅੱਜ ਕੱਲ੍ਹ ਜ਼ਿਆਦਾਤਰ ਆਪ ਨੌਕਰੀ ਪੇਸ਼ਾ ਹੁੰਦੇ ਐਂ ਜਿਸ ਨਾਲ਼ ਉਹ ਕਿ ਆਪਣੇ ਬੱਚਿਆਂ 'ਤੇ ਜ਼ਿਆਦਾ ਧਿਆਨ ਨਹੀਂ ਦੇ ਪਾਉਂਦੇ ਤਾਂ ਕਰਕੇ ਬੱਚਿਆਂ ਨੂੰ ਟਿਊਸ਼ਨ ਜਾਂ ਪ੍ਰਾਈਵੇਟ ਕਲਾਸਾਂ ਵੱਲ ਉਹਨਾਂ ਨੂੰ ਭੇਜਣਾ ਪੈਂਦਾ ਹੈ